ਸਾਨੂੰ ਆਪਣੀ ਜ਼ਿੰਦਗੀ ਦੇ ਕੁਝ ਰੁਝੇਵਿਆਂ ਤੋਂ ਸਮਾਂ ਕੱਢ ਕੇ ਕੁਝ ਸਮਾਂ ਅਜਿਹੀਆਂ ਗਤੀਆਂ ਵਿਧੀਆਂ ਵਿੱਚ ਲਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਮਨੋਰੰਜਨ ਵੀ ਕਰ ਸਕਦੇ ਹਾਂ ਅਤੇ ਦੂਜੇ ਸ਼ਬਦਾਂ ਵਿੱਚ ਅਸੀਂ ਇਹਨਾਂ ਨੂੰ ਸ਼ੌਕ ਵਜੋਂ ਵੀ ਅਪਣਾ ਸਕਦੇ ਹਾਂ ਜਿਵੇਂ ਮੇਰਾ ਮਨ ਪਸੰਦੀਦਾ ਸ਼ੌਕ ਬਾਗਬਾਨੀ ਹੈ ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਮੈਨੂੰ ਇਸਦੀ ਪ੍ਰੇਰਨਾ ਮੇਰੇ ਪਿਤਾ ਜੀ ਪਾਸੋਂ ਮਿਲੀ ਕਿਉਂਕਿ ਉਹ ਇੱਕ ਚੰਗੇ ਕਿਸਾਨ ਹੋਣ ਦੇ ਨਾਲ਼ ਨਾਲ਼ ਇੱਕ ਚੰਗੇ ਬਾਗ਼ਬਾਨ ਵੀ ਸਨ ਜਦੋਂ ਮੈਨੂੰ ਸੋਝੀ ਆਈ ਤਾਂ ਮੈਨੂੰ ਇਹ ਪਤਾ ਲੱਗਿਆ ਕਿ ਜੋ ਵੀ ਅਸੀਂ ਸਬਜ਼ੀਆਂ ਜਾਂ ਫ਼ਲ ਖਾਂਦੇ ਹਾਂ ਉਹ ਜ਼ਿਆਦਾਤਰ ਬਹੁਤ ਹੀ ਗ਼ਲਤ ਤਰੀਕੇ ਨਾਲ਼ ਉਗਾਏ ਜਾਂਦੇ ਨੇ ਅਤੇ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਨੇ ਅਤੇ ਭਿਆਨਕ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਜਾਂਦੀਆਂ ਹਨ ਇਹ ਸਾਰਾ ਕੁਝ ਮੈਨੂੰ ਮੇਰੇ ਪਿਤਾ ਜੀ ਪਾਸੋਂ ਪਤਾ ਲੱਗਿਆ ਇਸ ਤੋਂ ਇਲਾਵਾ ਮੈਨੂੰ ਮੇਰੇ ਸਕੂਲ ਅਧਿਆਪਕਾਂ ਤੋਂ ਵੀ ਇਸ ਬਾਰੇ ਇਸ ਬਾਰੇ ਬਹੁਤ ਪ੍ਰੇਰਨਾ ਮਿਲੀ ਮੇਰੇ ਕੁਝ ਅਧਿਆਪਕਾਂ ਨੇ ਵੀ ਮੈਨੂੰ ਬਾਗ਼ਬਾਨੀ ਕਰਨ ਲਈ ਪ੍ਰੇਰਿਆ ਸ਼ੁਰੂ ਸ਼ੁਰੂ ਵਿੱਚ ਮੈਂ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਬਗੀਚਾ ਲਗਾਇਆ ਉੱਥੇ ਮੈਂ ਤਰ੍ਹਾਂ ਤਰ੍ਹਾਂ ਦੇ ਫਲਾਂ ਦੇ ਬੂਟੇ ਫ ਫੁੱਲਾਂ ਦੇ ਬੂਟੇ ਅਤੇ ਸਬਜ਼ੀਆਂ ਦੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਵੇਂ ਜਿਵੇਂ ਮੇਰਾ ਧਿਆਨ ਇਹਨਾਂ ਨਾ ਇਹਨਾਂ ਵੱਲ ਵੱਧਦਾ ਗਿਆ ਤਾਂ ਮੈਂ ਸਰਕਾਰੀ ਬਾਗ਼ਬਾਨੀ ਵਿਭਾਗ ਤੋਂ ਵੀ ਬੂਟਿਆਂ ਦੀ ਦੇਖਭਾਲ ਸੰਬੰਧੀ ਜਾਣਕਾਰੀ ਲਈ ਅਤੇ ਉੱਥੋਂ ਵੀ ਮੈਨੂੰ ਬਾਗ਼ਬਾਨੀ ਦੇ ਕੁਝ ਮਹਾਂ ਡਾਕਟਰਾਂ ਵੱਲੋਂ ਪਤਾ ਲੱਗਿਆ ਕਿ ਅਸੀਂ ਇਹਨਾਂ ਬੂਟਿਆਂ ਨੂੰ ਕਿਵੇਂ ਬਿਨਾ ਰਸਾਇਣਾਂ ਤੋਂ ਸਪਰੇਹਾਂ ਤੋਂ ਪਾਲ ਸਕਦੇ ਹਾਂ ਮੈਂ ਅੱਗੇ ਜਾ ਕੇ ਵੀ ਇਸ ਜਿੰਦ ਇਸਨੂੰ ਜ਼ਿੰਦਗੀ ਵਿੱਚ ਕਿੱਤੇ ਵਜੋਂ ਅਪਣਾਵਾਂਗਾ ਅਤੇ ਮਿਹਨਤ ਕਰਾਂਗਾ ਅਤੇ ਹੋਰਨਾਂ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਾਂਗਾ ਤਾਂ ਕਿ ਕੁਝ ਹੋਰ ਬੇਰੁਜ਼ਗਾਰ ਜਿਹੜੇ ਆਪਣੇ ਨੌਜਵਾਨ ਨੇ ਉਹ ਇਸ ਨੂੰ ਇਸ ਸ਼ੌਕ ਨੂੰ ਆਪਣੇ ਕਿੱਤੇ ਵਜੋਂ ਅਪਣਾਉਣ ਅਤੇ ਚੰਗਾ ਮੁਨਾਫ਼ਾ ਖੱਟਣ ਧੰਨਵਾਦ